ਪੰਜਾਬੀ ਭਾਸ਼ਾ ਦੇ ਉੱਤੇ ਸੰਸਕ੍ਰਿਤ ਜਾਂ ਅੰਗਰੇਜ਼ੀ ਦੁਆਰਾ ਬਹੁਤ ਜ਼ਿਆਦਾ ਇਹਨਾਂ ਦਾ ਪ੍ਰਭਾਵ ਪਿਆ ਹੈ ਸੰਸਕ੍ਰਿਤ ਦੀ ਅਸੀਂ ਗੱਲ ਕਰੀਏ ਤਾਂ ਅ ਮੈਂ ਅਸੀਂ ਆਪਣੇ ਪੁਰਾਣੇ ਸਿਆਣਿਆਂ ਅ ਨੂੰ ਸੰਸਕ੍ਰਿਤ ਦੇ ਕਈ ਸ਼ਬਦ ਜਿਹੜੇ ਹੈਗੇ ਆ ਉਹ ਬੋਲਦੇ ਸੁਣਿਆ ਹੈ ਇਸ ਤੋਂ ਇਲਾਵਾ ਜਿਹੜੇ ਵੇਦ ਅ ਲਿਖੇ ਗਏ ਹਨ ਉਹਨਾਂ ਦੀਆਂ ਉਹ ਜਿਹੜੇ ਉਹਨਾਂ ਦੇ ਵਿੱਚ ਅ ਜੋ ਉਹਨਾਂ ਨੇ ਲਿਖ ਦਿੱਤਾ ਹੈ ਉਸੇ ਚੀਜ਼ ਨੂੰ ਉਦਾਹਰਣ ਬਣਾ ਕੇ ਮੈਂ ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਉਹਨਾਂ ਉਦਾਹਰਨਾਂ ਦੀ ਵਰਤੋਂ ਮੈਂ ਹੁੰਦੀ ਅ ਸੁਣੀ ਹੈ ਦੇਖੀ ਹੈ ਅਤੇ ਅਸੀਂ ਗੱਲ ਕਰੀਏ ਅੰਗਰੇਜ਼ੀ ਦੁਆਰਾ ਤਾਂ ਅੰਗਰੇਜ਼ੀ ਦੁਆਰਾ ਵੀ ਬਹੁਤ ਜ਼ਿਆਦਾ ਪ੍ਰਭਾਵ ਹੋਏ ਅੰਗਰੇਜ਼ ਅੰਗਰੇਜ਼ਾਂ ਤੋਂ ਅਸੀਂ ਬਹੁਤ ਸਾਰੇ ਸ਼ਬਦ ਵੀ ਲਏ ਹਨ ਉਹਨਾਂ ਦੀ ਬਹੁਤ ਸਾਰਾ ਜੀਵਨ ਸ਼ੈਲੀ ਨੂੰ ਵੀ ਅਸੀਂ ਨਕਲ ਕਰਦੇ ਹਾਂ ਔਰ ਉਹ ਨਕਲ ਹੁਣ ਤਾਂ ਇਤਨੀ ਕੁ ਜ਼ਿਆਦਾ ਪ੍ਰਚੱਲਿਤ ਹੋ ਗਈ ਹੈ ਕਿ ਉਸ ਉਸ ਚੀਜ਼ ਦਾ ਟਰੈਂਡ ਬਣ ਚੁੱਕਾ ਹੈ ਉਸ ਚੀਜ਼ ਦਾ ਜਿਹੜਾ ਹੈ ਨਾ ਜਿਹੜੀ ਸਾਡੀ ਯੂਥ ਹੈ ਜਿਹੜੀ ਸਾਡੀ ਜਵਾਨੀ ਹੈ ਉਹ ਇਸ ਚੀਜ਼ ਦਾ ਟਰੈਂਡ ਬਣ ਚੁੱਕਾ ਹੈ ਅ ਜਿਵੇਂ ਕਿ ਅਸੀਂ ਮੁੰਡੇ ਪੈਂਟ ਪਾਉਂਦੇ ਹਨ ਤਾਂ ਉਹ ਪੈਂਟ ਨੂੰ ਪੈਂਟ ਇੰਗਲਿਸ਼ ਸ਼ਬਦ ਹੈ ਅੰਗਰੇਜ਼ੀ ਦਾ ਸ਼ਬਦ ਹੈ ਪੈਂਟ ਜੈਕਿਟ ਸਵੈਟਰ ਅ ਅਤੇ ਇਹ ਜਿਹੜੀਆਂ ਚੀਜ਼ਾਂ ਹਨ ਉਹ ਇੱਦਾਂ ਹੀ ਉ ਉਹਨਾਂ ਦੇ ਸ਼ਬਦ ਐਜ਼ ਇਟ ਇੱਦੀ ਬੋਲੇ ਜਾਂਦੇ ਹਨ ਇਸ ਤੋਂ ਇਲਾਵਾ ਮੋਬਾਇਲ ਫੋਨ ਹੈ ਜਦੋਂ ਅਸੀਂ ਮੋਬਾਇਲ ਹੈ ਤਾਂ ਉਸਨੂੰ ਪੰਜਾਬੀ 'ਚ ਅਸੀਂ ਕਦੇ ਨਹੀਂ ਕਿਹਾ ਇਸ ਤੋਂ ਇਲਾਵਾ ਜਿਹੜੀ ਸਾਡੇ ਕੋਲ ਅਸੀਂ ਜਦੋਂ ਮੋਬਾਇਲ ਚੱਕਦੇ ਹਾਂ ਤਾਂ ਅਸੀਂ ਸਾਡੇ ਮੂੰਹ 'ਚੋਂ ਸੁਭਾਵਿਕ ਹੀ ਹੈਲੋ ਨਿਕਲਦਾ ਹੈ ਅਸੀਂ ਕਦੇ ਵੀ ਸਤਿ ਸ਼੍ਰੀ ਅਕਾਲ ਦਾ ਜਾਂ ਕਿਸੇ ਹੋਰ ਪੰਜਾਬੀ ਸ਼ਬਦ ਦਾ ਪ੍ਰਯੋਗ ਜਿਹੜਾ ਹੈ ਉਹ ਨਹੀਂ ਕੀਤਾ